ਪੰਜ ਜਨਵਰੀ ਦੋ ਹਜ਼ਾਰ ਦੋ ਸੱਤ ਫਰਵਰੀ ਦੋ ਹਜ਼ਾਰ ਪੰਜ ਦਸ ਮਾਰਚ ਉੱਨੀ ਸੌ ਨੱਬੇ ਦਸ ਨਵੰਬਰ ਉੱਨੀ ਸੌ ਅਠਾਨਵੇਂ ਛੱਬੀ ਜਨਵਰੀ ਉੱਨੀ ਸੌ ਪੰਜਾਹ